ਬਚਪਨ ਵਿੱਚ ਅਕਸਰ ਅਸੀਂ ਆਪਣੇ ਸਕੂਲਾਂ ਦੇ ਅਧਿਆਪਕਾਂ ਨੂੰ ਬਹੁਤ ਸਾਰੇ ਗਰੀਟਿੰਗ ਕਾਰਡ ਅਤੇ ਹੋਰ ਬਹੁਤ ਸਾਰੇ ਤੋਹਫ਼ੇ ਅਧਿਆਪਕ ਦਿਵਸ 'ਤੇ ਦਿੰਦੇ ਸਨ ਜਿਨ੍ਹਾਂ ਨੂੰ ਦੇਣ ਨਾਲ ਸਾਨੂੰ ਬਹੁਤ ਹੀ ਖੁਸ਼ੀ ਮਹਿਸੂਸ ਹੁੰਦੀ ਸਨ ਹੁੰਦੀ ਸੀ ਅਤੇ ਇਹ ਇਹ ਤੋਹਫ਼ੇ ਜ਼ਿਆਦਾਤਰ ਅਸੀਂ ਆਪਣੇ ਹੱਥਾਂ ਦੁਆਰਾ ਹੀ ਬਣਾਉਂਦੇ ਸਨ ਇਸ ਵਿੱਚ ਅਸੀਂ ਆਪਣੀ ਕਲਾ ਅਤੇ ਆਪਣੀ ਭਾਵਨਾਵਾਂ ਨੂੰ ਬਹੁਤ ਹੀ ਅੱਛੇ ਤਰੀਕੇ ਨਾਲ ਪੇਸ਼ ਕਰ ਸਕਦੇ ਸਨ ਅਤੇ ਅਸੀਂ ਜੋ ਸਾਡੇ ਅਧਿਆਪਕਾਂ ਦਾ ਆਦਰ ਸਤਿਕਾਰ ਹੈ ਉਹਨਾਂ ਨੂੰ ਸ਼ਬਦਾਂ ਵਿੱਚ ਅਸੀਂ ਪੇਸ਼ ਕਰ ਸਕਦੇ ਸਨ ਅਤੇ ਇਹਨਾਂ ਨਾਲ ਸਾਡੀਆਂ ਭਾਵਨਾਵਾਂ ਸਾਡੇ ਪਸੰਦੀਦਾ ਅਧਿਆਪਕਾਂ ਤੱਕ ਪਹੁੰਚਦੀਆਂ ਸਨ ਮੈਨੂੰ ਗਰੀਟਿੰਗ ਕਾਰਡ ਬਣਾਉਣ ਦਾ ਬਹੁਤ ਸ਼ੌਕ ਹੈ ਅਤੇ ਬਚਪਨ ਵਿੱਚ ਮੈਂ ਬਹੁਤ ਸਾਰੇ ਗਰੀਟਿੰਗ ਕਾਰਡ ਆਪਣੇ ਪਸੰਦੀਦਾ ਅਧਿਆਪਕਾਂ ਨੂੰ ਦਿੱਤੇ ਹਨ ਜਿਹਨਾਂ ਨੂੰ ਪ੍ਰਾਪਤ ਕਰਕੇ ਅਧਿਆਪਕ ਬਹੁਤ ਹੀ ਖੁਸ਼ ਹੋਏ ਸਨ ਅਤੇ ਉਹਨਾਂ ਨੂੰ ਬਹੁਤ ਹੀ ਆਦਰ ਅਤੇ ਸਤਿਕਾਰ ਪ੍ਰਾਪਤ ਹੋਇਆ